ਹਾਂਜੀ ਮੈਨੂੰ ਗਾਹਕਾਂ ਤੋਂ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਵਧੀਆ ਲੋਕ ਮਿਲ ਵਰਤਦੇ ਨੇ ਮੇਰੇ ਨਾਲ ਕਿਉਂਕੀ ਮੇਰਾ ਬੂਟੀਕ ਦਾ ਕੰਮ ਹੈ ਅਤੇ ਮੈਂ ਆਪਣੇ ਕੱਪੜੇ ਸਟਿਚ ਕਰਦੀ ਹਾਂ ਸਭ ਨੂੰ ਬਾਹਰ ਵੀ ਜਾਂਦੇ ਨੇ ਹੁਣ ਤਾਂ ਕਾਫ਼ੀ ਜੀ ਮੰਨ ਲਉ ਬਾਹਰਲੇ ਦੇਸ਼ਾਂ 'ਚ ਵੀ ਮੈਨੂੰ ਔਨਲਾਈਨ ਓਡਰ ਆਉਂਦੇ ਨੇ ਵੀ ਮੈਮ ਸਾਡਾ ਤੁਹਾਡਾ ਕੰਮ ਬਹੁਤ ਵਧੀਆ ਤੁਸੀਂ ਵਧੀਆ ਕੰਮ ਕਰਦੇ ਓ ਤਾਂ ਤੁਸੀਂ ਸਾਡੇ ਵੀ ਕੱਪੜੇ ਸਟਿਚ ਕਰੋ ਮੈਂ ਖੁਦ ਵੀ ਇੱਕ ਕਾਫ਼ੀ ਮਤਲਬ ਹੋਰ ਕੰਮ ਅੱਗੇ ਚਲਾ ਲਿਆ ਮੈਂ ਆਪਣਾ ਬੂਟੀਕ ਨੂੰ ਹੋਰ ਵਧਾਇਆ ਮੈਂ ਕੱਪੜਾ ਵੀ ਲਿਆ ਕੇ ਰੱਖਿਆ ਹੋਇਆ ਵੀ ਗਾਹਕ ਨੂੰ ਜੈਸਾ ਕੱਪੜਾ ਚਾਹੀਦਾ ਹੋਊਗਾ ਅਸੀਂ ਉਸੇ ਹੀ ਸੂਟ ਬਣਾ ਕੇ ਦੇਵਾਂਗੇ ਤਾਂ ਕਿ ਗਾਹਕ ਨੂੰ ਕੋਈ ਪ੍ਰੇਸ਼ਾਨੀ ਹੋਵੇ ਗਾਹਕ ਮੇਰੇ ਤੋਂ ਬਹੁਤ ਖੁਸ਼ ਹੁੰਦੇ ਆ ਉਹ ਮੈਨੂੰ ਕਹਿੰਦੇ ਮੈਮ ਤੁਹਾਡੇ ਵਰਗਾ ਤਾਂ ਕੋਈ ਕੱਪੜਾ ਸਟਿਚ ਕਰ ਹੀ ਨਹੀਂ ਸਕਦਾ ਇਸ ਲੀਏ ਜਦੋਂ ਮੈਨੂੰ ਇੰਨੀ ਵਧੀਆ ਫੀਡ ਵਧੀਆ ਲੋਕਾਂ ਦੇ ਰਿਸਪੋਂਸ ਮਿਲਦਾ ਲੋਕ ਵਧੀਆ ਮੈਨੂੰ ਸ ਕਹਿੰਦੇ ਨੇ ਤਾਂ ਫਿਰ ਮੈਂ ਵੀ ਲੋਕਾਂ ਨੂੰ ਕਈ ਵਾਰੀ ਆਪਣੇ ਵਜੋਂ ਮੈਨੂੰ ਜਿਹੜੇ ਜ਼ਿਆਦਾ ਹੀ ਮੰਨ ਲਉ ਦਿਲੋਂ ਪਿਆਰ ਕਰਦੇ ਨੇ ਉਨ੍ਹਾਂ ਨੂੰ ਵੀ ਮੈਂ ਆਪਣੇ ਵੱਲੋਂ ਵਧੀਆ ਇੱਕ ਗਿਫ਼ਟ ਦੇ ਤੌਰ 'ਤੇ ਕਹਿ ਲਉ ਇੱਕ ਸੂਟ ਸਟਿਚ ਕਰਕੇ ਫ੍ਰੀ 'ਚ ਹੀ ਦੇ ਦਿੰਦੇ ਹਾਂ ਤਾਂ ਕਿ ਉਨ੍ਹਾਂ ਨੂੰ ਗਿਫ਼ਟ ਦੇ ਦਿੱਤਾ ਜਾਂਦਾ ਤਾਂ ਕਿ ਉਨ੍ਹਾਂ ਨੂੰ ਪਸੰਦ ਆਵੇ ਇਸ 'ਤੇ ਲੋਕ ਮੈਨੂੰ ਬਹੁਤ ਵਧੀਆ ਕਹਿੰਦੇ ਨੇ ਉਹ ਕਹਿੰਦੇ ਵੀ ਤੁਹਾਡਾ ਹੁਨਰ ਬਹੁਤ ਵਧੀਆ ਤੁਸੀਂ ਬਹੁਤ ਸੋਚਦੇ ਓਂ ਅਤੇ ਚਾਰ ਪੰਜ ਹੋਰ ਵੀ ਗਾਹਕ ਨੇ ਐਸੇ ਜੋ ਕਿ ਕਹਿੰਦੇ ਨੇ ਮੈਮ ਤੁਸੀਂ ਹੋਰ ਕੰਮ ਵਧਾਉ ਤਾਂ ਕਿ ਮੈਂ ਕੁਛ ਬੱਚਿਆਂ ਨੂੰ ਵੀ ਰੱਖਿਆ ਹੋਇਆ ਉਨ੍ਹਾਂ ਨੂੰ ਫ੍ਰੀ ਸਟਿਚਿੰਗ ਦੱਸੀ ਜਾਂਦੀ ਹੈ ਤਾਂ ਕਿ ਵੀ ਵੀ ਉਨ੍ਹਾਂ ਦਾ ਵੀ ਕੋਈ ਕੰਮ ਬਣ ਸਕੇ ਅਤੇ ਹੋਰ ਲੋਕ ਕਹਿੰਦੇ ਨੇ ਵੀ ਮੈਮ ਤੁਸੀਂ ਬਹੁਤ ਵਧੀਆ ਕਰਦੇ ਓਂ ਕਿਉਂਕੀ ਗਰੀਬ ਲੜਕੀਆਂ ਨੂੰ ਜੋ ਸਟੀਚਿੰਗ ਫ੍ਰੀ ਸਿਖਲਾਈ ਦਿੱਤੀ ਜਾਂਦੀ ਹੈ ਉਹਤੋਂ ਉਹ ਕਾਫ਼ੀ ਖੁਸ਼ ਹੁੰਦੇ ਨੇ ਅਤੇ ਉਹ ਕਾਫ਼ੀ ਮੰਨ ਲਉ ਲੋਕ ਆਪਣਾ ਪ੍ਰਚਾਰ ਕਰਦੇ ਨੇ ਵੀ ਦੇਖੋ ਵੀ ਆਹ ਮੈਮ ਕੋਲ ਬੂਟੀਕ ਦਾ ਬਹੁਤ ਵਧੀਆ ਕੰਮ ਹੈ ਅਤੇ ਇੱਥੇ ਬ ਬੱਚਿਆਂ ਨੂੰ ਫ੍ਰੀ ਸਿਖਲਾਈ ਦਿੰਦੇ ਨੇ ਫ੍ਰੀ ਸਿ ਸਿਕਸ਼ਾ ਵੀ ਕਈ ਵਾਰੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਛੋਟੇ ਬੱਚੇ ਹੁੰਦੇ ਆ ਉਨ੍ਹਾਂ ਨੂੰ ਨਹੀਂ ਕੁਛ ਆਉਂਦਾ ਤਾਂ ਉਨ੍ਹਾਂ ਨੂੰ ਵੀ ਮੈਂ ਸ ਨਾਲ ਨਾਲ ਸਿਕਸ਼ਾ ਦਿੰਦੀ ਹਾਂ ਤਾਂ ਕਿ ਉਹ ਚੰਗੇ ਨਾਗਰਿਕ ਬਣ ਸਕਣ ਇਸ ਲਈ ਬ ਕੋ ਕਾਫ਼ੀ ਮੇਰੇ ਗਾਹਕ ਖੁਸ਼ ਹੁੰਦੇ ਹੈ ਅਤੇ ਮੇਰੇ ਹੁਨਰ ਤੋਂ ਕਾਫ਼ੀ ਪਸੰਦ ਕਰਦੇ ਹੈ